ਹੈਲੋ ਸਤਿ ਸ਼੍ਰੀ ਅਕਾਲ ਸਰ ਮੈਂ ਮੀਨਾਕਸ਼ੀ ਪਠਾਨਕੋਟ ਤੋਂ ਬੋਲ ਰਹੀ ਹਾਂ ਇੱਥੇ ਸਾਡੇ ਪਠਾਨਕੋਟ ਜ਼ਿਲ੍ਹੇ ਵਿੱਚ ਕਈ ਤਰ੍ਹਾਂ ਦੀ ਸਿਹਤ ਸੰਭਾਲ ਪ੍ਰਣਾਲੀਆਂ ਦਾ ਆਯੋਜਿਤ ਕੀਤੀਆਂ ਗਈਆਂ ਹਨ ਜਿਸ ਵਿੱਚ ਪਠਾਨਕੋਟ ਦੇ ਹਰ ਮੁਹੱਲੇ ਗਲੀ ਵਿੱਚ ਮੁਹੱਲਾ ਕਲੀਨਿਕ ਖੋਲ੍ਹੇ ਗਏ ਹਨ ਜਿਸ ਵਿੱਚ ਬੱਚੇ ਬਜ਼ੁਰਗ ਔਰਤਾਂ ਦੀ ਆਪਣਾ ਚੈੱਕਅਪ ਫਰੀ ਚੈੱਕਅਪ ਕਰਵਾ ਸਕਦੀਆਂ ਅਤੇ ਉਹਨਾਂ ਨੂੰ ਦਵਾਈਆਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਅਤੇ ਸਿਹਤ ਸੰਭਾਲ ਸੰਬੰਧੀ ਕੋਈ ਡਾਕਟਰੀ ਪ੍ਰਣਾਲੀ ਉਹਨਾਂ ਨੂੰ ਦਿੱਤੀ ਜਾਂਦੀ ਹੈ ਅਤੇ ਜੇਕਰ ਸ ਸਾਡੇ ਜੇਕਰ ਗੱਲ ਕਰੀਏ ਆਪਣੇ ਪਿੰਡ ਦੀ ਤਾਂ ਸਾਡੇ ਪਿੰਡ ਵਿੱਚ ਵੀ ਕਈ ਗੁਰਦੁਆਰਿਆਂ ਅਤੇ ਕਈ ਸਥਾਨਾਂ 'ਤੇ ਕੈਂਪ ਵਗੈਰਾ ਲਗਾਏ ਜਾਂਦੇ ਹਨ ਜਿਸ ਵਿੱਚ ਪਿੰਡ ਦੇ ਲੋਕ ਆਪਣਾ ਫਰੀ ਚੈੱਕਅਪ ਕਰਵਾਉਂਦੇ ਹਨ ਜਿਵੇਂ ਅੱਖਾਂ ਅੱਖਾਂ ਪੇਟ ਵਗੈਰਾ ਸਭ ਦੇ ਚੈੱਕਅਪ ਕੀਤੇ ਜਾਂਦੇ ਹਨ ਅਤੇ ਕਈ ਫਰੀ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਅਤੇ ਕਈ ਤਰ੍ਹਾਂ ਦੀਆਂ ਨੋਲਿਜ ਦਿੱਤੀ ਜਾਂਦੀ ਹੈ ਤਾਂ ਜੋ ਉਹਨਾਂ ਨੂੰ ਸਭ ਤਰ੍ਹਾਂ ਦੀਆਂ ਸਹੂਲਤਾਂ ਦਵਾਂ ਮੁਹੱਈਆਂ ਕੀਤੀਆਂ ਜਾਣ ਅਤੇ ਜੇਕਰ ਗੱਲ ਕਰੀਏ ਹੋਣ ਵਾਲੀ ਸਰਕ ਸਰ ਸਰਕਾਰ ਦੀ ਤਾਂ ਇਸਨੇ ਕਈ ਤਰ੍ਹਾਂ ਦੀਆਂ ਪ੍ਰਣਾਲੀਆਂ ਆਯੋਜਿਤ ਕੀਤੀਆਂ ਹਨ ਤਾਂ ਜੋ ਆਮ ਅ ਆਮ ਨਾਗਰਿਕ ਨੂੰ